ਹੈਲੋ ਸਤਿ ਸ਼੍ਰੀ ਅਕਾਲ ਮੈਂ ਅਰੁਣਾ ਬੋਲ ਰਹੀ ਹਾਂ ਮੁਹਾਵਰੇ ਅਤੇ ਕਿੰਨਾ ਨਹੀਂ ਪੰਜਾਬੀ ਕਵਿਤਾਏ ਸਾਡੇ ਪੰਜਾਬ 'ਚ ਬਹੁਤ ਹੈ ਸਾਡੇ ਇੱਕ ਗੱਲ ਦੇ ਦੋ ਮਤਲਬ ਨਿਕਲਦੇ ਆ ਕੋਈ ਵੀ ਗੱਲ ਹੈ ਜਿੱਦਾਂ ਬੱਚਾ ਕਹਿੰਦਾ ਨਹੀਂ ਕੋਈ ਸ਼ਰਾਰਤ ਕਰਦਾ ਤਾਂ ਅਸੀਂ ਕਹਿੰਦੇ ਹਾਂ ਜਿੰਨਾ ਮਰਜ਼ੀ ਕਹਿ ਲਓ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਸਕਦੀ ਜਿੰਨਾ ਮਰਜ਼ੀ ਸਮਝਾ ਲਓ ਇਹ ਨਹੀਂ ਸਮਝ ਸਕਦਾ ਅਤੇ ਜੇ ਅਸੀਂ ਕਹਿੰਦੇ ਹਾਂ ਵੀ ਕਿੰਨਾ ਨਹੀਂ ਨੱਚਣਾ ਨਾ ਆਏ ਤਾਂ ਆਂਗਨ ਟੇਢਾ ਨੱਚਣਾ ਨਾ ਆਏ ਤਾਂ ਅਸੀਂ ਆਂਗਨ ਟੇਢਾ ਕਹਿ ਦਿੰਦੇ ਹਾਂ ਵੀ ਜਿਹਨੂੰ ਨਹੀਂ ਸਮਝ ਆਉਂਦੀ ਤਾਂ ਉਹਨੂੰ ਅਸੀਂ ਐਦਾਂ ਬੋਲ ਦਿੰਦੇ ਹਾਂ ਅਤੇ ਇਹ ਵਾ ਵੀ ਕਿੰਨਾ ਨਹੀਂ ਬੱਚਿਆਂ ਦੇ ਕਿੰਨਾ ਨਹੀਂ ਬਹੁਤ ਹੁੰਦੇ ਜੇ ਕਿੰਨਾ ਨਹੀਂ ਪੰਜਾਬ ਸਾਡੇ ਦੇ ਵਿੱਚ ਬੜੇ ਆਉਂਦੀਆਂ ਕਵਿਤਾ ਵੀ ਆਉਂਦੀਆਂ ਮੁਹਾਵਰੇ ਇੱਕ ਰਸੋਈ ਦੇ ਵਿੱਚ ਆਲੂ ਉਲੂ ਐਦਾਂ ਬੋਲ ਦਿੰਦੇ ਆ ਇੱਕ ਗੱਲ ਦੇ ਦੋ ਮਤਲਬ ਨਿਕਲਦੇ ਆ ਚਾਹ ਚੂਹ ਪੀ ਲਉ ਰੋਟੀ ਰੂਟੀ ਖਾ ਲਓ ਐਦਾਂ ਬਹੁਤ ਜ਼ਿਆਦਾ ਅਸੀਂ ਕਹਿੰਦਾ ਨਹੀਂ ਕਹਿ ਦਿੰਦੇ ਹਾਂ ਅਤੇ ਇਹ ਵਾ ਵੀ ਕਿੰਨਾ ਨਹੀਂ ਸਾਡੇ ਪੰਜਾਬ ਦੇ ਵਿੱਚ ਹੈ ਹੀ ਬਹੁਤ ਜ਼ਿਆਦਾ ਵਾ ਇੱਕ ਗੱਲ ਦੇ ਦੋ ਦੋ ਮਤਲਬ ਨਿਕਲਦੇ ਆ ਜਾਂ ਕਿੰਨਾ ਨਹੀਂ ਕੋਈ ਵੀ ਗੱਲ ਹੈ ਜਿਹਨੂੰ ਕੋਈ ਸਮਝ ਨਾ ਆਏ ਤਾਂ ਅਸੀਂ ਉਹਨੂੰ ਵੀ ਐਦਾਂ ਹੀ ਬੋਲਦੇ ਦਿੰਦੇ ਹਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਸਕਦੀ ਜਿੰਨਾ ਮਰਜ਼ੀ ਇਹਨੂੰ ਕਹਿ ਲਓ ਇਹਨੇ ਉਹ ਹੋਣਾ ਹੀ ਹੋਣਾ ਵਾ ਇਹਨੇ ਨਹੀਂ ਸਿੱਧੀ ਹੋਣਾ ਅਤੇ ਇਹ ਵਾ ਵੀ ਜਿੱਦਾਂ ਮਰਜ਼ੀ ਕਿੰਨਾ ਨਹੀਂ ਕਰ ਲਉ ਇਹਨਾਂ ਦੇ ਕਿੰਨਾ ਨਹੀਂ ਵੀ ਜਿੱਦਾਂ ਹੁਣ ਸਬਜ਼ੀ ਸਬਜ਼ੀ ਭਾਜੀ ਉਹ ਵੀ ਸਬਜ਼ੀ ਭਾਜੀ ਵੀ ਇੱਕ ਗੱਲ ਦੇ ਦੋ ਮਤਲਬ ਨਿਕਲਦੇ ਆ ਸਾਡੇ ਪੰਜਾਬ ਦੇ ਵਿੱਚ ਇੱਕ ਗੱਲ ਦੀਆਂ ਦੋ ਬੜੀਆਂ ਉਹ ਹੋ ਜਾਂਦੀਆਂ ਵਾ ਜਿੰਨਾ ਮਰਜ਼ੀ ਸਮਝਾ ਲਓ ਕਿੰਨਾ ਨਹੀਂ ਕਿ ਕਿੰਨਾ ਨਹੀਂ ਔਰ ਔਰ ਸਾਡੇ ਕਿੰਨਾ ਨਹੀਂ ਪੰਜ ਬਹੁਤ ਵਧੀਆ ਵਾ ਪੰਜਾਬ ਬਹੁਤ ਸਾਡੇ ਅਸੀਂ ਹੈ ਹੀ ਪੰਜਾਬ 'ਚ ਰਹਿੰਦੇ ਹਾਂ ਘਰ ਦੇ ਵਿੱਚ ਸ ਐ ਕੋਈ ਵੀ ਗੱਲ ਹੋਏ ਤਾਂ ਐਦਾਂ ਹੀ ਮੁਹਾਵਰਿਆਂ ਨਾਲ ਹੀ ਗੱਲਾਂ ਅਸੀਂ ਕਰ ਲੈਂਦੇ ਹਾਂ ਔਰ ਕੀ ਕਿੰਨਾ ਨਹੀਂ